ਜੇਕਰ ਆਪਾਂ ਕਿਸੇ ਲੰਬੀ ਬਾਈਕਿੰਗ ਯਾਤਰਾ ਜਾਂ ਟੂਰ ਲਈ ਨਿਕਲ ਰਹੇ ਹਾਂ ਠੀਕ ਆ ਜਾਂ ਤਿਆਰ ਹੋ ਰਹੇ ਹਾਂ ਤਾਂ ਸਭ ਤੋਂ ਪਹਿਲਾਂ ਹਾਨੂੰ ਆਪਣੀ ਸੇਫਟੀ ਦਾ ਧਿਆਨ ਰੱਖਣਾ ਆ ਠੀਕ ਹੈ ਜਿਵੇਂ ਆਪਾਂ ਜੇਕਰ ਲੰਬੇ ਟੂਰ 'ਤੇ ਜਾ ਰਹੇ ਹਾਂ ਹਾਡੀ ਪੂਰੀ ਸੇਫਟੀ ਹੋਣੀ ਚਾਹੀਦੀ ਆ ਉਸ ਟੂਰ ਦੇ ਦੌਰਾਨ ਠੀਕ ਆ ਹਾਨੂੰ ਬਾਈਕ ਦੀ ਪ੍ਰੋਪਰ ਚੈਕਿੰਗ ਕਰਨੀ ਹੈ ਕਿ ਹਾਂ ਉਹ 'ਚ ਕੋਈ ਮਤਲਬ ਦਿੱਕਤ ਨਾ ਆਵੇ ਜੋ ਅੱਗੇ ਜਾ ਕੇ ਰਸਤੇ ਵਿੱਚ ਹਾਨੂੰ ਪ੍ਰੋਬਲਮ ਕ੍ਰੀਏਟ ਕਰੇ ਆਪਣਾ ਖਾਣ ਪੀਣ ਦਾ ਪ੍ਰੋਪਰ ਉੰਨਾ ਸਮਾਨ ਲੈ ਕੇ ਜਾਣਾ ਠੀਕ ਆ ਆਪਣੇ ਕੱਪੜੇ ਲੀੜੇ ਵਧੀਆ ਤਰੀਕੇ ਨਾਲ ਲੈ ਕੇ ਜਾਣੇ ਕਿਉਂਕਿ ਆ ਲੰਬਾ ਟੂਰ ਆ ਪਤਾ ਨੀ ਕਿੰਨੇ ਦਿਨ ਲੱਗਣ ਇਸ ਕਰਕੇ ਆਪਾਂ ਨੂੰ ਪੂਰੀ ਪੈਕਿੰਗ ਵਗੈਰਾ ਕਰਕੇ ਜਾਣੀ ਉਸ ਤੋਂ ਬਾਅਦ ਕੋ ਜੇਕਰ ਆਪਾਂ ਆਪਣੀ ਗੱਡੀ 'ਤੇ ਜਾ ਰਹੇ ਹਾਂ ਤਾਂ ਉਹਦੇ ਕੁਝ ਛੋਟੀ ਛੋਟੀ ਚੀਜ਼ਾਂ ਆਪਾਂ ਸਿੱਖ ਲਈਏ ਕਿ ਕਿਵੇਂ ਠੀਕ ਹੋ ਸਕਦੀ ਜੇਕਰ ਕੋਈ ਛੋਟਾ ਮੋਟਾ ਨੁਕਸ ਪੈ ਜਾਏ ਉਹ ਆਪਾਂ ਖੁਦ ਹੀ ਠੀਕ ਕਰ ਲਈਏ ਰੈਦਰ ਦੈਨ ਕਿ ਆਪਾਂ ਕਿਸੇ ਨੂੰ ਉਡੀਕੀਏ ਕਿ ਕੋਈ ਠੀਕ ਕਰਨ ਆਵੇ ਉਹਦੇ ਵਾਸਤੇ ਆਪਾਂ ਇੱਕ ਛੋਟੀ ਜਿਹੀ ਇੱਕ ਟੂਲ ਕਿੱਟ ਆਪਣੇ ਨਾਲ ਰੱਖ ਸਕਦੇ ਹਾਂ ਜੋ ਹਾਨੂੰ ਹੈਲਪ ਕਰੇਗੀ ਕਿ ਚਲੋ ਅੱਗੇ ਜਾ ਕੇ ਬਾਈ ਚਾਂਸ ਕੋਈ ਛੋਟੀ ਮੋਟੀ ਦਿੱਕਤ ਆਉਂਦੀ ਹੈ ਤਾਂ ਆਪਾਂ ਟੂਲ ਕਿੱਟ ਦੀ ਮਦਦ ਨਾਲ ਉਹਨੂੰ ਖੋਲ੍ਹ ਖੋਲ੍ਹ ਕੇ ਕਿਸੇ ਤਰ੍ਹਾਂ ਆਪਾਂ ਉਹਨੂੰ ਠੀਕ ਕਰ ਦੇਈਏ ਠੀਕ ਆ ਸੈਕਿੰਡ ਥਿੰਗ ਆਪਾਂ ਪ੍ਰੋਪਰ ਸੇਫਟੀ ਦੇ ਨਾਲ ਡਰਾਈਵਿੰਗ ਕਰਾਂਗੇ ਬਿਨਾਂ ਇੰਡੀਕੇਟਰ ਦਿੱਤੇ ਮੋੜ ਨਹੀਂ ਮੋੜਾਂਗੇ ਠੀਕ ਆ ਤਾਂ ਕਿ ਉਹ ਹਾਨੂੰ ਵੀ ਬਚਾਵੇ ਅਤੇ ਦੂਜਿਆਂ ਦੀ ਵੀ ਲਾਈਫ ਬਚਾਵੇ ਠੀਕ ਆ ਤੀਜੀ ਚੀਜ਼ ਕਿ ਆਪਾਂ ਪੂਰੀ ਮਤਲਬ ਕਿ ਹੈਲਮਟ ਵਗੈਰਾ ਦਾ ਯੂਸ ਕਰਕੇ ਜਾਵਾਂਗੇ ਠੀਕ ਆ ਐਕਸਟਰਾ ਪੈਟ੍ਰੋਲੀਅਮ ਆਪਣੇ ਨਾਲ ਥੋੜ੍ਹਾ ਕੈਰੀ ਕਰ ਲਾਂਗੇ ਕਿ ਬਾਈ ਚਾਂਸ ਕੀ ਆ ਕਿਤੇ ਰਸਤੇ ਐਸੇ ਇਸ ਤਰ੍ਹਾਂ ਦੇ ਰਸਤੇ 'ਚ ਮੁੜ ਜਾਈਏ ਜਿੱਥੇ ਪੈਟ੍ਰੋਲੀਅਮ ਟੈਂਕ ਹੀ ਨਾ ਹੋਵੇ ਤਾਂ ਉੱਥੇ ਆਪਾਂ ਉਹਨੂੰ ਯੂਸ ਕਰ ਸਕੀਏ ਅਤੇ ਇਸ ਪ੍ਰਕਾਰ ਆਪਾਂ ਆਪਣੀ ਸੇਫਟੀ ਦਾ ਧਿਆਨ ਰੱਖਾਂਗੇ